ਸਤਿ ਸ਼੍ਰੀ ਅਕਾਲ ਸਰ ਮੈਂ ਤੁਹਾਡੀ ਕੰਪਨੀ ਤੋਂ ਫੋਨ ਖਰੀਦਿਆ ਸੀ ਅਤੇ ਇਸ ਦੀ ਡਿਲੀਵਰੀ ਦੋ ਦਿਨ ਬਾਅਦ ਆਈ ਹੈ ਅਤੇ ਜਦੋਂ ਮੈਂ ਇਸ ਨੂੰ ਖੋਲ੍ਹ ਕੇ ਦੇਖਿਆ ਅਤੇ ਇਸ ਉੱਪਰ ਸਕਰੈਚ ਪਏ ਹੋਏ ਸੀ ਅਤੇ ਜਦੋਂ ਮੈਂ ਇਸ ਨੂੰ ਔਨ ਕੀਤਾ ਅਤੇ ਇਸ ਦੇ ਸਕਰੀਨ ਦੇ ਉੱਤੇ ਲਾਈਨਾਂ ਆਈਆਂ ਹੋਈਆਂ ਸੀ ਜਦੋਂ ਮੈਂ ਇਸ ਦਾ ਸਪੀਕਰ ਅਤੇ ਕੈਮਰਾ ਚੈੱਕ ਕੀਤਾ ਅਤੇ ਉਹ ਦੋਵੇਂ ਖਰਾਬ ਸੀ ਸਪੀਕਰ ਦੀ ਆਵਾਜ਼ ਫਟੀ ਹੋਈ ਸੀ ਅਤੇ ਇਸ ਦੀ ਬੈਟਰੀ ਬੈਕਅਪ ਵੀ ਬਹੁਤ ਹੀ ਘੱਟ ਹੈ